ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਗੁੜਤੀ ਦੀ ਰਸਮ ਨਿਭਾਈ ਜਾਂਦੀ ਹੈ ਗੁੜਤੀ ਦੀ ਰਸਮ ਨਿਭਾਉਣ ਲਈ ਬੱਚੇ ਦੀ ਮਿੱਠੇ ਦੀ ਵਰਤੋਂ ਕਰਦੇ ਹਾਂ ਗੁੜਤੀ ਵੱਡ ਵਡੇਰੇ ਵੱਲੋਂ ਦਿੱਤੀ ਜਾਂਦੀ ਹੈ ਤਾਂ ਜੋ ਬੱਚੇ ਦੇ ਗੁਣ ਸੁਭਾਅ ਵੱਡੇ ਵੱਡ ਵਡੇਰੇ 'ਤੇ ਜਾਣ ਉਸ ਤੋਂ ਬਾਅਦ ਬੱਚਾ ਇੱਕੀ ਦਿਨ ਦਾ ਹੁੰਦਾ ਹੈ ਤਾਂ ਘਰ ਵਿੱਚ ਪਾਠ ਕਰਵਾਇਆ ਜਾਂਦਾ ਹੈ ਪਾਠ ਕਰਵਾਉਣ ਲ ਲਈ ਬਾਬੇ ਵੱਲੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਉਹਦੇ ਬੱਚੇ ਦੇ ਮੂੰਹ ਨੂੰ ਲਗਾਇਆ ਜਾਂਦਾ ਹੈ ਤਾਂ ਜੋ ਬੱਚਾ ਸਿੱਖ ਧਰਮ ਨਾਲ ਜੁੜ ਸਕੇ ਜੁੜ ਸਕੇ ਅਤੇ ਬਾਬੇ ਵੱਲੋਂ ਪਗੜੀ ਦੀ ਪਗੜੀ ਵੀ ਬੰਨੀ ਜਾਂਦੀ ਹੈ ਫਿਰ ਬੱਚੇ ਦਾ ਸਵਾ ਮਹੀਨਾ ਕੀਤਾ ਜਾਂਦਾ ਹੈ ਜੋ ਨਾਨਕਿਆਂ ਵੱਲੋਂ ਰਸਮ ਨਿਭਾਈ ਜਾਂਦੀ ਹੈ ਉਸ ਦਾ ਜਣੇਪਾ ਲੈ ਕੇ ਆਉਂਦੇ ਹਨ